ਜਿਹੜੀਆਂ ਚੁਣੌਤੀਆਂ ਨੇ ਉਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਨੇ ਗੀਆਂ ਇਨ੍ਹਾਂ ਤੋਂ ਵੀ ਸਾਡੀ ਜ਼ਿੰਦਗੀ ਜਿਹੜੀ ਹੈ ਬੇਸਵਾਦੀ ਜੀ ਲੱਗਦੀ ਹੈ ਹੁਣ ਹਰੇਕ ਦੀ ਜ਼ਿੰਦਗੀ ਵਿੱਚ ਹਰੇਕ ਲੈਵਲ ਦੀਆਂ ਚੁਣੌਤੀਆਂ ਆਉਂਦੀਆਂ ਨੇ ਉਹ ਚੁਣੌਤੀਆਂ ਹਰੇਕ ਦੀ ਜ਼ਿੰਦਗੀ ਵਿੱਚ ਅਲੱਗ ਅਲੱਗ ਹੀ ਹੁੰਦੀਆਂ ਨੇ ਜਿਵੇਂ ਮੈਂ ਇੱਕ ਵਿਦਿਆਰਥੀ ਹਾਂ ਮੇਰੀ ਲਾਈਫ 'ਚ ਵਿਦਿਆਰਥੀ ਵਾਲੀਆਂ ਹੀ ਚੁਣੌਤੀਆਂ ਆਈਆਂ ਸੀਗੀਆਂ ਅਤੇ ਜਿਹੜੇ ਕਿ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਂ ਜਦੋਂ ਅਪਣੀ ਪਲਸ ਟੂ ਕਲੀਅਰ ਕੀਤੀ ਸੀਗੀ ਓਦੋਂ ਕਰੋਨਾ ਦਾ ਟਾਈਮ ਚੱਲ ਰਿਹਾ ਸੀ ਮੈਂ ਆਪਣੇ ਫਿਊਚਰ ਬਾਰੇ ਸੋਚਿਆ ਕਿ ਮੈਂ ਹਾਂ ਬਾਹਰ ਜ ਬਾਹਰ ਜਾਣਾ ਅਤੇ ਉਹਦੇ ਲਈ ਮੈਨੂੰ ਆਈਲੈਟਸ ਦੀ ਜ਼ਰੂਰਤ ਪੈਣੀ ਸੀ ਕਰਨ ਦੀ ਤਾਂ ਉਹ ਮੈਂ ਕਰਨ ਦੀ ਸਲਾਹ ਬਣਾਈ ਪਰ ਕੋਰੋਨਾ ਹੋ ਗਿਆ ਜਿਹਦੇ ਕਰਕੇ ਕਿ ਛੇ ਮਹੀਨੇ ਸਾਰਾ ਕੁਛ ਬਿਲਕੁਲ ਹੀ ਬੰਦ ਰਿਹਾ ਮੈਂ ਕਿਤੇ ਬਾਹਰ ਵੀ ਨਹੀਂ ਗਈ ਨਾ ਮੈਨੂੰ ਕਿਤੇ ਕੋਚਿੰਗ ਵੀ ਨਹੀਂ ਮਿਲੀ ਹੈਗੀ ਪਰ ਮੈਂ ਫਿਰ ਵੀ ਹਿੰਮਤ ਨਹੀਂ ਹਾਰੀ ਹੈਗੀ ਮੈਂ ਫਿਰ ਵੀ ਆਪਣੀ ਕੋਚਿੰਗ ਓਨਲਾਈਨ ਯੂਟੀਊਬ ਨੇ ਮੇਰੀ ਬਹੁਤ ਸਹਾਇਤਾ ਕੀਤੀ ਉਤੋਂ ਮੈਨੇ ਬਹੁਤ ਕੁਝ ਸਿੱਖਿਆ ਆਈਲੈਟਸ ਬਾਰੇ ਬੀ ਮੈਨੇ ਸਾਰੀ ਉਹ ਤੋਂ ਹੀ ਟਰੇਨਿੰਗ ਲਈ ਫਿਰ ਇੱਦਾਂ ਹੀ ਕਰਕੇ ਜਦੋਂ ਛੇ ਮਹੀਨੇ ਬਾਅਦ ਜਿਹੜਾ ਸੀਗਾ ਕੋਵਿਡ ਉਹ ਖੁੱਲ੍ਹਿਆ ਪਹਿਲਾਂ ਤਾਂ ਮੈਂ ਐਗਜ਼ਾਮ ਦੇਣ ਤੋਂ ਬਹੁਤ ਹੀ ਜ਼ਿਆਦਾ ਨਰਵਸ ਜੀ ਹੋ ਗਈ ਵੀ ਹਾਏ ਮੈਂ ਕਿਵੇਂ ਕਰੂੰਗੀ ਕਿਉਂਕਿ ਮੈਂ ਕਦੇ ਪਹਿਲਾਂ ਕਿਤੇ ਸਪੀਕਿੰਗ ਦਿੱਤੀ ਵੀ ਨਹੀਂ ਸੀਗੀ ਅਤੇ ਜਦੋਂ ਮੈਨੇ ਪਹਿਲਾ ਇਗਜ਼ਾਮ ਦਿੱਤਾ ਉਸ ਤੋਂ ਬਾਅਦ ਮੇਰਾ ਥੋੜ੍ਹੇ ਕੁ ਦਿਨਾਂ ਬਾਅਦ ਇਹਦਾ ਰਿਜ਼ਲਟ ਆ ਗਿਆ ਫਿਰ ਜਦੋਂ ਮੈਨੇ ਆ ਰਿਜ਼ਲਟ ਚੈਕ ਕੀਤਾ ਤਾਂ ਮੈਂ ਇੰਨੀ ਇਹ ਸੱਤ ਬੈਂਡ ਨਾਲ ਪਾਸ ਕਰ ਲਈ ਅਤੇ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੁਣੌਤੀ ਸੀ ਜਿਹਨੂੰ ਮੈਂ ਪਾਰ ਕੀਤਾ ਅਤੇ ਸ ਹਰੇਕ ਦੀ ਲਾਈਫ ਵਿੱਚ ਹੁੰਦੀਆਂ ਨੇ ਸਾਰੀਆਂ ਚੁਣੌਤੀਆਂ ਆਉਂਦੀਆਂ ਨੇ ਸਾਨੂੰ ਇਨ੍ਹਾਂ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਇਨ੍ਹਾਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ